ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਹਾਂਜੀ ਅੱਛਾ ਜੀ ਇਹ ਤੁਸੀਂ ਸੀਮੇਂਟ ਲੈਣਾ ਕਾਹਦੇ ਵਾਸਤੇ ਆ ਜੀ ਮ ਮਕਾਨ ਕਿੰਨੇ ਗਜ ਦਾ ਕਿੰਨਾ ਪ ਚਾਹੀਦਾ ਆਪ ਜੀ ਨੂੰ ਹਾਂਜੀ ਅੱਛਾ ਜੀ ਨਹੀਂ ਵੀ ਉਹ ਕਿੰਨੀ ਬੋਰੀਆਂ ਕਿੰਨੀਆਂ ਬੋਰੀਆਂ ਚਾਹੀਦੀਆਂ ਸੌ ਬੋਰੀ ਚਾਹੀਦੀ ਆ ਅਤੇ ਤੁਸੀਂ ਕਿ ਤੁਸੀਂ ਆਹੋ ਉਹ ਤਾਂ ਮਿਲ ਜਾਵੇਗਾ ਤੁਸੀਂ ਲੈਣਾ ਕਿਹੜਾ ਚਾਹੁੰਦੇ ਹੋ ਅੱਛਾ ਅੰਬੂਜਾ ਅਤੇ ਜੇ ਤੁਸੀਂ ਇਕੱਠਾ ਲਵੋਂਗੇ ਤਾਂ ਉਹਦੇ ਪਿੱਛੇ ਉਹ ਉਸ ਹਿਸਾਬ ਦੇ ਨਾਲ ਉਹ ਕਟੌਤੀ ਕੀਤੀ ਜਾਵੇਗੀ ਉਹ ਤੁਹਾਨੂੰ ਬਾਅਦ 'ਚ ਦੱਸ ਦਿਆਂਗੇ

ਅਸੀਂ ਹਫ਼ਤੇ ਤੱਕ ਵਧੀਆ ਸੀਮੇਂਟ ਸਾਡੇ ਕੋਲ ਆਉਣ ਵਾਲਾ ਅਤੇ ਹਫ਼ਤੇ ਤੱਕ ਤੁਹਾਡੇ ਪਹੁੰਚਦਿਆਂ ਕਰ ਦੇਵਾਂਗੇ ਅਤੇ ਹਾਂਜੀ ਅਤੇ ਆਪਣਾ ਤੁਸੀਂ ਅਡਰੈਸ ਦੇ ਦੇਣਾ ਸਾਨੂੰ ਠੀਕ ਆ ਜੀ ਹਾਂਜੀ ਇੱਕ ਬੋਰੀ ਦਾ ਰੇਟ ਹੈਗਾ ਤਿੰਨ ਸੌ ਦੇ ਨੇੜੇ ਆ ਜੀ ਤਿੰਨ ਕੁ ਸੌ ਹਿਸਾਬ ਦੇ ਨਾਲ ਲੱਗ ਜੂ ਹਾਂਜੀ ਹਾਂਜੀ ਹਾਂਜੀ ਬਸ ਕੋਈ ਨਹੀਂ ਆਉਣ ਦਿਓ ਸਾਡੇ ਕੋਲ ਨਵਾਂ ਆ ਰਿਹਾ ਆ ਵਧੀਆ ਕੁਆਲਿਟੀ 'ਚ ਅਸੀਂ ਜਦੋਂ ਹੀ ਸਾਡੇ ਪਹੁੰਚ ਹੋਵੇਗੀ ਉਦੋਂ ਹੀ ਤੁਹਾਡੇ ਕੋਲ ਪਹੁੰਚਦਾ ਕਰ ਦੇਣਾ ਅਤੇ ਨਹੀਂ ਕੋਈ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ ਹਾਂ ਉਹੀ ਤਾਂ ਦੁਕਾਨਦਾਰ ਨੂੰ ਤਾਂ ਇਹ ਹੀ ਹੁੰਦਾ ਵੀ ਜਿਹੜੀ ਉਹਦੇ ਕੋਲ ਵਸਤੂ ਹੈ ਉਹ ਉਹਦੀ ਕੁਆਲਿਟੀ ਹੋਵੇ ਅਤੇ ਉਹਦੀ ਦੁਕਾਨਦਾਰੀ ਅੱਗੇ ਹੋਰ ਵੱਧ ਗਈ ਜਿਵੇਂ ਤੁਸੀਂ ਇਸ ਤਰ੍ਹਾਂ ਕਿਹਾ ਤਾਂ ਜਦੋਂ ਤੁਸੀਂ ਇਹ ਚੀਜ਼ ਵਰਤੋਂਗੇ ਤੁਹਾਨੂੰ ਮਿਸਤਰੀ ਕਹਿਣਗੇ ਵੀ ਇਹ ਬਹੁਤ ਵਧੀਆ ਸਮਿੰਟ ਹੈ ਹਾਂ ਫਿਰ ਤੁਸੀਂ ਆਪਣੇ ਅਗਾਂਹ ਰਿਸ਼ਤੇਦਾਰਾਂ ਨੂੰ ਵੀ ਹੋਰਾਂ ਨੂੰ ਵੀ ਜਿਉਂ ਜਦੋਂ ਤੁਸੀਂ ਇਸ ਤਰ੍ਹਾਂ ਇਹਦੇ ਬਾਰੇ ਦੱਸੋਂਗੇ ਤਾਂ ਉਹਦੇ 'ਚ ਸਾਨੂੰ ਹੀ ਇਹਦੇ ਵਿੱਚ ਫਾਇਦਾ ਹੈ ਨਾ ਸਾਡੀ ਦੁਕਾਨਦਾਰੀ ਜਿਹੜੀ ਹੈ ਉਹ ਪੱਕੀ ਹੁੰਦੀ ਹੈ ਸਾਡੇ ਗਾਹਕ ਵੱਧਦੇ ਨੇ ਹੈ ਸਾਡੇ ਗਾਹਕ ਤਾਂ ਫਿਰ ਇਸ ਅ ਇਹਦੀ ਅਗਾਂਹ ਜਿਵੇਂ ਹੁਣ ਤੁਸੀਂ ਕਿਹਾ ਉਹ ਅੱਗੇ ਵੀ ਮਸ਼ਹੂਰੀ ਕਰਦੇ ਨੇ ਇਹ ਮਸ਼ਹੂਰੀ ਦੇ ਨਾਲ ਫਿਰ ਅਸੀਂ ਸਾਨੂੰ ਵੀ ਬਲ ਵਧੀਆ ਲੱਗਦਾ ਅਸੀਂ ਵੀ ਫਿਰ ਵਧੀਆ ਕੁਆਲਟੀ ਦੀ ਜਿਹੜਾ ਹੋਰ ਵਧੀਆ ਕੁਆਲਿਟੀ ਦੀਆਂ ਯਾਨੀ ਸੀਮਿੰਟ ਵਗੈਰਾ ਮੰਗਵਾ ਕੇ ਅਸੀਂ ਇਸ ਤਰ੍ਹਾਂ ਆਪਣੇ ਗਾਹਕਾਂ ਦੀ ਸੇਵਾ ਵੱਧ ਤੋਂ ਵੱਧ ਕਰਦੇ ਰਹੀਏ ਹਾਂਜੀ ਕੋਈ ਗੱਲ ਨਹੀਂ ਜ਼ਰੂਰ ਭੇਜ ਦਾਂਗੇ ਧੰਨਵਾਦ